ਹੈਲੋ ਸਰ ਸਤਿ ਸ਼੍ਰੀ ਅਕਾਲ ਜੀ ਸਰ ਆਪਾਂ ਨੂੰ ਬੱਚਿਆਂ ਦੀਆਂ ਟੋਆਏ ਗੇਮਸ ਮਿਲ ਜਾਣਗੀਆਂ ਜੀ ਹਾਂਜੀ ਸਰ ਸਰ ਦੋ ਦਿਖਾ ਦਿਓ ਜੀ ਹਾਂਜੀ ਇੱਕ ਸਰ ਦਾਰ ਬ ਕਾਰ ਵਾਲੀ ਦਿਖਾ ਦਿਓ ਇੱਕ ਐਰੋਪਲੇਨਾ ਵਾਲੀ ਦਿਖਾ ਦਿਓ ਹਾਂਜੀ ਸਰ ਦੋਨੋਂ ਦਿਖਾ ਦਿਓ ਹਾਂਜੀ ਸਰ ਇਹਦੀਆਂ ਫੀਚਰਸ ਦੱਸੋ ਜੀ ਸਾਨੂੰ ਕਿਸ ਤਰ੍ਹਾਂ ਨੇਗੀਆਂ ਵੀ ਐਰੋਪਲੇਨ ਦੀਆਂ ਕਿਵੇਂ ਨੇਗੀਆਂ ਅਤੇ ਕਾਰ ਵਾਲੀਆਂ ਕਿਵੇਂ ਹਾਂਜੀ ਸਰ ਸਰ ਹਾਂਜੀ ਬੱਚਿਆਂ ਦੇ ਲਈ ਲੈਣੀ ਆ ਹਾਂਜੀ ਸਰ ਹਾਂਜੀ ਸਰ ਵ ਹਾਂਜੀ ਇਹ ਗੱਡੀ ਵਾਲੀ ਦਿਖਾਇਓ ਸਰ ਹਾਂਜੀ ਸਰ ਇਹਦੀਆਂ ਜਿਹੜੀਆਂ ਇਹ ਵਾਲੀਆਂ ਐਲਮੀਰਾ ਨੇਗੀਆਂ ਇਹ ਆਪਣੀਆਂ ਰਿਮੋਟ ਨਾਲ ਖੁੱਲ੍ਹਣਗੀਆਂ ਅੱਛਾ ਸਰ ਅਤੇ ਇਹ ਐਰੋਪਲੇਨ ਵੀ ਸਰ ਹਾਂਜੀ ਸਰ ਰਿਮੋਟ ਨਾਲ ਹੀ ਚੱਲੂਗਾ ਸਰ ਜ਼ਿਆਦਾ ਵਧੀਆ ਫੀਚਰਸ ਕਿਸ ਦੀਆਂ ਹੋਣਗੀਆਂ ਰਿਮੋਟ ਵਾਲੀ ਕਾਰ ਵਾਲੀ ਦੀਆਂ ਹੋਣਗੀਆਂ ਜਾਂ ਐਰੋਪਲੇਨ ਦੀਆਂ ਠੀਕ ਹੈ ਜੀ ਸਰ ਮੈਨੂੰ ਇੰਝ ਲੱਗਦਾ ਹੈਗਾ ਜੀ ਵੀ ਕਾਰ ਵਾਲੀ ਜ਼ਿਆਦਾ ਵਧੀਆ ਰਹੂਗੀ ਜੀ ਸਰ ਤੁਸੀਂ ਹਾਂਜੀ ਫਿਰ ਬੱਚਿਆਂ ਲਈ ਠੀਕ ਹੈ ਸਰ ਲੈਣੀ ਪਵੇਗੀ ਸਰ ਇੱਕ ਵਾਰੀ ਦੋਨੋਂ ਦਿਖਾ ਦਿਓ ਜੀ ਹਾਂਜੀ ਚਲਾ ਕੇ ਵੀ ਦਿਖਾਇਓ ਠੀਕ ਹੈ ਸਰ ਬਹੁਤ ਵਧੀਆ ਹੈਗਾ ਜੀ ਠੀਕ ਹੈ ਤੁਸੀਂ ਇੰਝ ਕਰੋ ਸਰ ਜਿਹੜੀਆਂ ਕਾਰ ਵਾਲੀ ਹੈਗੀ ਇਹਦੀ ਸਾਨੂੰ ਪੂਰੇ ਦੱਸੋ ਸਰ ਵੀ ਕਿਵੇਂ ਇਹ ਚੱਲੂਗੀ ਕਿਵੇਂ ਇਹ ਹਾਂਜੀ ਵਰਕ ਕਰੂਗੀ ਠੀਕ ਹੈ ਸਰ ਬੱਚੇ ਮਤਲਬ ਰਿਮੋਟ ਦੇ ਨਾਲ ਹੀ ਚੱਲੂਗੀ ਸਰ ਕਿ ਵੈਸੇ ਵੀ ਚੱਲ ਸਕਦੀ ਆ ਠੀਕ ਹੈ ਸਰ ਇਹਦੇ ਜਾਂ ਆਪਾਂ ਇਹ ਕਹਿ ਸਕਦੇ ਹਾਂ ਸਰ ਵੀ ਐਰੋਪਲੇਨ ਨਾਲੋਂ ਕਾਰ ਵਾਲੀ ਜਿਹੜੀ ਗੇਮ ਹੈ ਇਹ ਜ਼ਿਆਦਾ ਵਧੀਆ ਹੈਗੀ ਹਾਂਜੀ ਸਰ ਤੁਸੀਂ ਐਂ ਕਰੋ ਜੀ ਜਿਹੜੀ ਇਹ ਕਾਰ ਵਾਲੀ ਗੇਮ ਹੈਗੀ ਇਹਨੂੰ ਪੈਕ ਕਰ ਦਿਓ ਸਰ ਹਾਂਜੀ ਥੈਂਕ ਯੂ ਸੋ ਮਚ